ਮੈਨੂੰ ਤਾਂ ਬਾਗਬਾਨੀ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ ਅਤੇ ਉਹਦੇ ਨਾਲ ਨਾਲ ਮੇਰੀ ਬੇਟੀ ਨੂੰ ਵੀ ਹੈਗੀ ਹੈ ਮੇਰੀ ਬੇਟੀ ਵੀ ਬੜੀ ਦ ਦਿਲਚਸਪੀ ਰੱਖਦੀ ਉਹਦਾ ਵੀ ਦਿਲ ਕਰਦਾ ਜਦੋਂ ਮੈਂ ਗਮਲਿਆਂ ਦੇ ਵਿੱਚ ਕਈ ਵਾਰੀ ਪਾਣੀ ਪਾਉਣਾ ਰਹਿ ਜਾਂਦਾ ਮੇਰੇ ਕੋਲੋਂ ਸਵੇਰੇ ਮੈਂ ਲੇਟ ਹੁੰਦੀ ਹੋਵਾਂ ਤਾਂ ਫਿਰ ਪਿੱਛੋਂ ਪਾ ਦਿੰਦੀ ਹੈ ਬੜੀ ਦੇਖ ਰੇਖ ਕਰਦੀ ਹੈ ਉਹਨਾਂ ਦੀ